ਹਾਂ ਅੱਜ ਦੇ ਟਾਈਮ ਵਿੱਚ ਕਾਫੀ ਕੁਛ ਥਾਵਾਂ ਹਨ ਜਿਹੜੀਆਂ ਆਮ ਤੌਰ 'ਤੇ ਚੰਗੀਆਂ ਤਸਵੀਰਾਂ ਨੂੰ ਕੈਪਚਰ ਕਰਨ ਲਈ ਅਸੀਂ ਘੁੰਮਦੇ ਹਾਂ ਤਕਰੀਬਨ ਤੁਸੀਂ ਦੇਖ ਲਓ ਚਾਹੇ ਚੰਡੀਗੜ੍ਹ ਚਲੇ ਜਾਓ ਚੰਡੀਗੜ੍ਹ ਦੇ ਵਿੱਚ ਜਿਸ ਤਰ੍ਹਾਂ ਸੁਖਨਾ ਲੇਕ ਹੋ ਗਿਆ ਪਿੰਜੋਰ ਹੋ ਗਿਆ ਰੋਜ਼ ਰੋਕ ਗਾਰਡਨ ਹੋ ਗਿਆ ਰੋਜ਼ ਗਾਰਡਨ ਹੋ ਗਿਆ ਇੱਛੇ ਚਲੇ ਜਾਓ ਇਹਨਾਂ ਜਗ੍ਹਾਵਾਂ 'ਤੇ ਵੀ ਬਹੁਤ ਸੋਹਣੀਆਂ ਤਸਵੀਰਾਂ ਲਈਆਂ ਜਾ ਸਕਦੀਆਂ ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਪਹਾੜੀ ਇਲਾਕਿਆਂ ਵਿੱਚ ਚਲੇ ਜਾਓ ਜਿਸ ਤਰ੍ਹਾਂ ਕੁੱਲੂ ਮਨਾਲੀ ਆਪਣਾ ਇੱਥੇ ਇਹਨਾਂ ਵਿੱਚ ਇਹਨਾਂ ਜਗ੍ਹਾਵਾਂ 'ਤੇ ਚਲੇ ਜਾਓ ਰੋਹਤਾਂਗ ਹੋ ਗਿਆ ਕਸ਼ਮੀਰ ਹੋ ਗਿਆ ਅਤੇ ਇਹਨਾਂ ਜਗ੍ਹਾਵਾਂ 'ਤੇ ਚਲੇ ਜਾਓ ਇਹਨਾਂ 'ਤੇ ਇੰਨਾ ਸੋਹਣਾ ਪ੍ਰਕਿਰਤੀ ਦੇ ਨਜ਼ਾਰੇ ਹੁੰਦੇ ਆ ਬਹੁਤ ਸ਼ਾਂਤ ਮਾਹੌਲ ਹੁੰਦਾ ਇੰਨਾ ਇਹਨਾਂ ਪ੍ਰਕਿਰਤੀ ਦੇ ਨਜ਼ਾਰਿਆਂ ਨੂੰ ਹੀ ਆਪਾਂ ਤਸਵੀਰਾਂ ਵਿੱਚ ਕੈਦ ਕਰ ਸਕਦੇ ਹਾਂ ਔਰ ਔਰ ਇੱਥੇ ਆਮ ਤੌਰ 'ਤੇ ਬਹੁਤ ਅੱਛੇ ਸੀਨ ਹੁੰਦੇ ਆ ਦ੍ਰਿਸ਼ ਹੁੰਦੇ ਹਨ ਬਹੁਤ ਸੋਹਣੇ ਨੇਚਰ ਦੇ ਪ੍ਰਕਿਰਤੀ ਦੇ ਸ਼ਾਂਤੀ ਦਾ ਮਾਹੌਲ ਹੁੰਦਾ ਹੈ ਜਿੱਦਾਂ ਮਰਜ਼ੀ ਅਸੀਂ ਤਸਵੀਰਾਂ ਲੈ ਸਕਦੇ ਹਨ ਇਸ ਤੋਂ ਇਲਾਵਾ ਆਪਾਂ ਅਸੀਂ ਇੱਧਰ ਚਲੇ ਜਾਈਏ ਜਿੱਦਾ ਹਰਦੁਆਰ ਤੋਂ ਅੱਗੇ ਚਲੇ ਜਾਓ ਹਰਦੁਆਰ ਤੋਂ ਅੱਗੇ ਚਲੇ ਜਾਓ ਸਾਰਾ ਪਹਾੜੀ ਇਲਾਕਾ ਹੈਗਾ ਉਧਰਲੇ ਪਾਸੇ ਚਲੇ ਜਾਓ ਉੱਥੇ ਤੁਹਾਨੂੰ ਬਹੁਤ ਸਾਰੀਆਂ ਤਸਵੀਰਾਂ ਆਪਾਂ ਨੂੰ ਮਿਲਣ ਮਿਲਦੀਆਂ ਹਨ ਜਿਹਨਾਂ ਨੂੰ ਆਪਾਂ ਫੋਨ ਦੇ ਵਿੱਚ ਕੈਪਚਰ ਕਰ ਸਕਦੇ ਹਾਂ ਅਤੇ ਜਿਸ ਨਾਲ ਸਾਨੂੰ ਹੋਰ ਨਵੀਆਂ ਨਵੀਆਂ ਜਗ੍ਹਾਵਾਂ ਦੇ ਬਾਰੇ 'ਚ ਨਵੀਆਂ ਨਵੀਆਂ ਚੀਜ਼ਾਂ ਦੇ ਬਾਰੇ ਵਿੱਚ ਪਤਾ ਨਵੀਂ ਜਗ੍ਹਾ ਦਾ ਪਤਾ ਲੱਗਦਾ ਹੈ ਨਵੇਂ ਨਵੇਂ ਕੁਛ ਨਾ ਕੁਛ ਦੇਖਣ ਨੂੰ ਆਪਾਂ ਉਹਨੂੰ ਨਵੀਆਂ ਜਗ੍ਹਾਵਾਂ ਨੂੰ ਆਪਣੇ ਫੋਨ ਵਿੱਚ ਕੈਪਚਰ ਕਰਦੇ ਹਨ ਨਵਾਂ ਨਵੇਂ ਤਰ੍ਹਾਂ ਦਾ ਸਾਨੂੰ ਐਕਸਪੀਰੀਅੰਸ ਹੁੰਦਾ ਹੈ